ਹੈਲੋ ਨਮਸਕਾਰ ਜੀ ਹਾਂਜੀ ਹਾਂਜੀ

ਤੁਸੀਂ ਨਾ ਆਪਣਾ ਰਜ਼ਿਊਮ ਮੈਨੂੰ ਸੈਂਡ ਕਰੋ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਡੇਟ ਆਫ ਬਰਥ ਟਾਈਮ ਵਗੈਰਾ ਉਹਦੇ 'ਚ ਡਿਟੇਲ ਵਗੈਰਾ ਭਰਨੀ ਪਏਗੀ ਤੁਹਾਡਾ ਕੋਈ ਬਰਾਇਰ ਐਕਸਪੀਰੀਅੰਸ ਹੈਗਾ ਉਹ ਲਿਖਣਾ ਪਏਗਾ ਠੀਕ ਆ ਅਤੇ ਜਿਸ ਫੀਲਡ ਦੀ ਪ੍ਰੈਫਰੈਂਸ ਹੈਗੀ ਆ ਉਹ ਸਾਨੂੰ ਦੱਸਣੀ ਪਏਗੀ ਅਤੇ ਸਾਡੇ ਕੋਲ ਬੈਂਕਾਂ 'ਚ ਵਕੈਂਸੀਆਂ ਇੰਸ਼ੋਰੈਂਸ ਸੈਕਟਰ 'ਚ ਹੈਗੀਆਂ ਔਰ ਟੀਚਿੰਗ ਲਾਈਨ 'ਚ ਵੀ ਹੈਗੀ ਆ ਜੀ ਦੇਖੋ ਬੈਂਕਿੰਗ 'ਚ ਜਾ ਸਕਦੇ ਹੋ ਇੰਸ਼ੋਰੈਂਸ 'ਚ ਵੀ ਜਾ ਸਕਦੇ ਹੋ ਟੀਚਿੰਗ ਲਾਈਨ 'ਚ ਵੀ ਜਾ ਸਕਦੇ ਹੋ ਔਰ ਉਹਦੇ ਵਾਸਤੇ ਜਿਹੜੀ ਟੀਚਿੰਗ ਵਾਸਤੇ ਇਸ ਤਰਾਂ ਹੈਗਾ ਕਿ ਤੁਸੀਂ ਆਪਣਾ ਰਜ਼ਿਊਮ ਮੈਨੂੰ ਸੈਂਡ ਕਰੋ ਅਤੇ ਗੌਰਮੈਂਟ ਸਕੂਲ 'ਚ ਲੱਗਣਾ ਕਿ ਪ੍ਰਾਈਵੇਟ ਸਕੂਲ 'ਚ ਲੱਗਣਾ ਉਹ ਲਿਖਣਾ ਪਏਗਾ ਅਤੇ ਉਹਦੇ ਹਿਸਾਬ ਨਾਲ ਅਸੀਂ ਇਥੇ ਆਪਣਾ ਸਕੂਲਾਂ ਨੂੰ ਕੰਟੈਕਟ ਸਾਡੇ ਹੈਗੇ ਨੇ ਸਕੂਲ ਅਤੇ ਉਹ ਸਾਰੀ ਡਿਟੇਲ ਉਹਨਾਂ ਨੂੰ ਪਾਵਾਂਗੇ ਅਤੇ ਉਹ ਤੁਹਾਨੂੰ ਇੰਟਰਵਿਊ 'ਚ ਬੁਲਾਉਣਗੇ ਅਤੇ ਤੁਹਾਨੂੰ ਪਹਿਲੇ ਆਪਣੇ ਏਜੰਸੀ 'ਚ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਏਗਾ ਇਹਦੇ ਵਾਸਤੇ ਮਾਰਕੀਟਿੰਗ ਨਾਲ ਹੁੰਦਾ ਹੈ ਥੋੜ੍ਹਾ ਜਿਹਾ ਟ੍ਰੇਨਿੰਗ ਵਗੈਰਾ ਦਿੰਦੇ ਉਹ ਤਾਂ ਟ੍ਰੇਨਿੰਗ ਦੇ ਕੇ ਤੁਹਾਨੂੰ ਉਹ ਸੈਕਟਰ ਦੇ ਵਿੱਚ ਇੰਡਕਟ ਕਰ ਦਿੰਦੇ ਆ ਉਹ ਪੰਦਰਾਂ ਕੁ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜਿਹਦੇ 'ਚ ਉਹ ਸਾਰਾ ਇੱਕ ਇੰਗਜ਼ਾਮ ਵੀ ਦੇਣਾ ਪੈਂਦਾ ਉਹਦੇ ਵਾਸਤੇ ਉਹ ਇੰਗਜ਼ਾਮ ਇਹ ਡਿਪੈਂਡ ਕਰਦਾ ਤੁਸੀਂ ਕਿਸ ਏਰੀਏ ਨੂੰ ਬਿਲੋਂਗ ਕਰਦੇ ਹੋ ਉਸ ਏਰੀਏ ਦੇ ਵਿੱਚ ਵਕੈਂਸੀ ਲੱਭ ਦਿਆਂਗੇ ਇਹਨਾਂ ਨੂੰ ਇੰਸ਼ੋਰੈਂਸ ਸੈਕਟਰ 'ਚ